ਪੰਜਾਬ ਦੇ ਪਿੰਡਾਂ 'ਚ ਜਦੋਂ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੱਪ ਡੰਗ ਮਾਰ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਲੋਕ ਸੱਪ ਦੇ ਜ਼ਹਿਰ ਨੂੰ ਬੰਨਣ 'ਚ ਭਰੋਸਾ ਰੱਖਦੇ ਹਨ ਉਹ ਬਾਬਿਆਂ ਕੋਲੋਂ ਧਾਗੇ ਤਵੀਤ ਕਰਵਾਉਣ ਨੂੰ ਪਹਿਲ ਦਿੰਦੇ ਸਨ ਜਾਂ ਫਿਰ ਜ਼ਹਿਰ ਨੂੰ ਚੂਸ ਵੀ ਲੈਂਦੇ ਸਨ ਕਈ ਲੋਕ ਉਸ ਥਾਂ ਤੇ ਕੱਟ ਮਾਰ ਦਿੰਦੇ ਹਨ ਜਿੱਥੇ ਸੱਪ ਨੇ ਡੰਗ ਮਾਰਿਆ ਹੋਵੇ ਜਦਕਿ ਮੈਡੀਕਲ ਪੱਖ ਤੋਂ ਪ੍ਰਾਪਤ ਗੱਲਾਂ ਸਹੀ ਨਹੀਂ ਹਨ ਅਤੇ ਕਿਸ ਦਾ ਸਹੀ ਲਾਭ ਹਸਪਤਾਲ ਵਿੱਚ ਹੀ ਕੀਤਾ ਜਾ ਸਕਦਾ ਹੈ ਉਹ ਦਸ ਬਿਮਾਰੀਆਂ ਜੋ ਬਣ ਸਕਦੀਆਂ ਨੇ ਮਹਾਂਮਾਰੀ ਸਭ ਖਤਰੇ 'ਚ ਹਨ ਚਿੜੀਆਂ ਕੀ ਅਤੇ ਇੱਲਾਂ ਕੀ ਸੱਪ ਦੇ ਡੰਗ ਮਾਰਨ 'ਤੇ ਕਦੇ ਵੀ ਪੀੜਤ ਵਿਅਕਤੀ ਨੂੰ ਬਹੁਤ ਹੀ ਹਿਲਜੁਲ ਨਹੀਂ ਕਰਨੀ ਚਾਹੀਦੀ ਇੱਥੋਂ ਤੱਕ ਕਿ ਉਸ ਨੂੰ ਤੁਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਵਿੱਚ ਜ਼ਹਿਰ ਜਲਦੀ ਫੈਲਦਾ ਹੈ ਪੰਜਾਬ ਸਰਕਾਰ ਕੋਲ ਸੱਪ ਫੜਨ ਵਾਲਾ ਕੋਈ ਵੀ ਮਾਹਿਰ ਨਹੀਂ ਹੈ ਪਰ ਉਹ ਕੋਈ ਮਸ਼ੀਨ ਜ਼ਰੂਰ ਲੱਭ ਰਹੇ ਹਨ ਵੀ ਉਸ ਤੋਂ ਬਚਿਆ ਜਾ ਸਕੇ ਭਾਰਤੀ ਜੰਗਲੀ ਜੀਵਾਂ ਬਾਰੇ ਦੇ ਐਕਟ ਉੱਨੀ ਸੌ ਸੱਤਰ ਦੇ ਐਕਟ ਅਨੁਸਾਰ ਸੱਪ ਨੂੰ ਮਾਰਨਾ ਇੱਕ ਅਪਰਾਧ ਹੈ ਇਸ ਵਿੱਚ ਤਿੰਨ ਤੋਂ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਦਸ ਹਜ਼ਾਰ ਤੋਂ ਵੱਧ ਦਾ ਜੁਰਮਾਨਾ ਵੀ ਹੋ ਸਕਦਾ ਹੈ ਕਾਨੂੰਨ ਅਨੁਸਾਰ ਸੱਪ ਜੇ ਨੁਕਸਾਨ ਨਹੀਂ ਕਰਦਾ ਤਾਂ ਫਿਰ ਉਸਨੂੰ ਮਾਰਨਾ ਜ਼ੁਰਮ ਹੈ ਭਾਰਤ ਵਿੱਚ ਸੱਪਾਂ ਦੀਆਂ ਕਿਸਮਾਂ ਦੋ ਸੌ ਪੰਝੱਤਰ ਦੇ ਕਰੀਬ ਦੱਸੀਆਂ ਜਾਂਦੀਆਂ ਹਨ ਜਦਕਿ ਪੰਜਾਬ ਵਿੱਚ ਸੱਪਾਂ ਦੀਆਂ ਕਿਸਮਾਂ ਪੰਜਾਹ ਤੋਂ ਸੱਠ ਦੇ ਕਰੀਬ ਹਨ ਅੱਜ ਅੱਜ ਕੱਲ੍ਹ ਬਹੁਤ ਜ਼ਿਆਦਾ ਸੱਪ ਮਿਲ ਰਹੇ ਹਨ ਜਿਵੇਂ ਕੋਬਰਾ ਰੈਡ ਸਨੇਕ ਕਰੇਟ ਪੰਜਾਬ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਹਾਲਾਂਕਿ ਗੈਰ ਸਰਕਾਰੀ ਅੰਕੜੇ ਵਿੱਚ ਇਸ ਤੋਂ ਕਿਤੇ ਵੱਧ ਦੱਸ ਦੱਸੇ ਜਾਂਦੇ ਹਨ ਸਮੁੱਚੇ ਭਾਰਤ ਵਿੱਚ ਹਰ ਸਾਲ ਸੱਪਾਂ ਦੇ ਡੰਗਣ ਨਾਲ ਪੰਜਾਹ ਹਜ਼ਾਰ ਵਿਅਕਤੀ ਮੌਤ ਦੇ ਮੂੰਹ 'ਤੇ ਚਲ ਚਲੇ ਜਾਂਦੇ ਹਨ ਇਹ ਦਾਅਵਾ ਰੁਮਲੇਸ ਵਿਕਟਰ ਕਰਦੇ ਹਨ ਜਿਹੜੇ ਕਿ ਸੱਪਾਂ ਬਾਰੇ ਹਰ ਤਰ੍ਹਾਂ ਦੀ ਮੁਹਾਰਤ ਰੱਖਦੇ ਹਨ ਉਹ ਅਮਰੀਕਾ ਛੱਡ ਕੇ ਉੱਨੀ ਸੌ ਸੱਤਰ ਤੋਂ ਭਾਰਤ 'ਚ ਆ ਕੇ ਰਹਿਣ ਲੱਗ ਗਏ ਸਨ ਸਾਲ ਦੋ ਹਜ਼ਾਰ ਅਠਾਰ੍ਹਾਂ ਵਿੱਚ ਉਹਨਾਂ ਨੂੰ ਪਦਮਸ਼੍ਰੀ ਨਾਲ ਵੀ ਨਿਵਾਜ਼ਿਆ ਗਿਆ ਉਹਨਾਂ ਦੇ ਮੁਤਾਬਿਕ ਦੁਨੀਆਂ ਵਿੱਚ ਹਰ ਸਾਲ ਫਿਫਟੀ ਫੋਰ ਲੱਖ ਲੋਕਾਂ ਨੂੰ ਸੱਪ ਡੰਕ ਮਾਰਦੇ ਹਨ